ਹਾਂ ਮੈਂ ਚਿੱਤਰਕਾਰੀ ਦਾ ਕੰਮ ਕਰਿਆ ਸੀ ਚਿਤ ਮੈਂ ਜਿਵੇਂ ਖੂਹ ਤੋਂ ਪਾਣੀ ਭਰਦੀਆਂ ਮੁਟਿਆਰਾਂ ਅਤੇ ਕੋਈ ਭੰਗੜਾ ਗਿੱਧਾ ਪਾਉਂਦੀਆਂ ਮੁਟਿਆਰਾਂ ਦੀ ਪੇਂ ਚਿੱਤਰਕਾਰੀ ਦਾ ਕੰਮ ਕੀਤਾ ਸੀ ਉਸ ਟੈਮ 'ਤੇ ਮੈਂ ਸਕੂਲਾਂ ਵਿੱਚ ਚਿੱਤਰਕਾਰੀ ਦਾ ਕੰਮ ਕੀਤਾ ਸੀ ਪਰ ਹੁਣ ਮੇਰੀ ਉਮਰ ਜ਼ਿਆਦਾ ਹੋਣ ਕਰਕੇ ਮੇਰੇ ਹੱਥ ਕੰਬਦੇ ਹਨ ਨਿਗ੍ਹਾ ਵੀ ਕਮਜ਼ੋਰ ਹੋ ਰਹੀ ਹੈ ਇਸ ਲਈ ਮੈਂ ਹੁਣ ਚਿੱਤਰਕਾਰੀ ਦਾ ਕੰਮ ਨਹੀਂ ਕਰ ਸਕਦੀ